ਸਾਡੇ ਵਿਚਾਰ ਵਿੱਚ ਸਾਨੂੰ ਸਾਡੇ ਇਲਾਕੇ ਲਈ ਆਵਾਜਾਈ ਅਤੇ ਯਾਤਰਾ ਦੇ ਵਿਕਲਪਾਂ ਨੂੰ ਬਿਹਤਰ ਬਣਾਉਣ ਲਈ ਬਹੁਤ ਸਾਰੇ ਕਦਮ ਚੁੱਕੇ ਜਾ ਸਕਦੇ ਹਨ ਜਿਵੇਂ ਕਿ ਸਾਰੇ ਇਕੱਠੇ ਹੋ ਕੇ ਪੇਂਡੂ ਨਿਵਾਸੀਆਂ ਲਈ ਯਾਤਰਾ 'ਤੇ ਜਾਣ ਲਈ ਇੱਕ ਬੱਸ ਜਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਸਾਡੇ ਲਾਗੇ ਸ਼ਾਗੇ ਦੇ ਕਈ ਪਿੰਡਾਂ ਵਿੱਚ ਯਾਤਰਾ ਲਈ ਧਰਮ ਸਥਾਨ 'ਤੇ ਜਾਣ ਲਈ ਫ੍ਰੀ ਸੰਸਥਾਵਾਂ ਦੀ ਵਰਤੋਂ ਕੀਤੀ ਗਈ ਹੈ ਸਾਨੂੰ ਵੀ ਆਪਣੇ ਪਿੰਡ ਲਈ ਪਿੰਡ ਦੇ ਨਿਵਾਸੀਆਂ ਲਈ ਫ੍ਰੀ ਯਾਤਰਾ ਦੀ ਸਰਵਿਸ ਕੀਤੀ ਜਾਣੀ ਚਾਹੀਦੀ ਹੈ ਜੋ ਕਿ ਸਾਰੇ ਪਿੰਡ ਨਿਵਾਸੀਆਂ ਨੂੰ ਇਕੱਠੇ ਹੋ ਕੇ ਕਰਨਾ ਪਵੇਗਾ